ਪੰਜਾਬ ਵਿੱਚ ਜਿਹੜੀ ਸਰਕਾਰ ਆ ਉਹਨਾਂ ਨੇ ਕਾਫੀ ਅੱਜ ਕੱਲ੍ਹ ਮਤਲਬ ਸਿੱਖ ਉੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਉਹ ਉਹ ਔਰਗਨਾਈਜ਼ ਕਰਨੀਆਂ ਸ਼ੁਰੂ ਕੀਤੀਆਂ ਨੇ ਜਿਵੇਂ ਅੱਜ ਕੱਲ੍ਹ ਉਹ ਬੇਟੀ ਪੜਾਓ ਬੇਟੀ ਬਚਾਓ ਸਕੀਮਾਂ ਦੇ ਰਹੇ ਨੇ ਅਤੇ ਈਵਨ ਜਿਹੜੀ ਪੋਸਟ ਮੈਟਰਿਕ ਸਕੋਲਰਸ਼ਿਪ ਵੀ ਆਉਂਦੀ ਆ ਜਿਹਦੇ ਵਿੱਚ ਜਿਹੜੇ ਐਸ ਸੀ ਸਕੋਲਰਸ ਮਤਲਬ ਬੱਚੇ ਹੈਗੇ ਨੇ ਉਹਨਾਂ ਨੂੰ ਬਿਲਕੁਲ ਮੁਫਤ ਜਿਹੜੀ ਆ ਉਹ ਸਿੱਖਿਆ ਦਿੱਤੀ ਜਾ ਰਹੀ ਆ ਉਹਨਾਂ ਨੂੰ ਬਸ ਇੱਕ ਰਜਿਸਟਰ ਕਰਵਾਉਣਾ ਹੁੰਦਾ ਪੋਰਟਲ ਦੇ ਉੱਤੇ ਅਤੇ ਉਹਨਾਂ ਦੇ ਜਿਹੜੇ ਸਾਰੇ ਪੈਸੇ ਹੈਗੇ ਨੇ ਉਹ ਸਰਕਾਰ ਹੀ ਪ੍ਰੋਵਾਈਡ ਕਰਦੀ ਆ ਅਤੇ ਹੋਰ ਵੀ ਬਹੁਤ ਸਾਰੇ ਐਸੇ ਬੱਚੇ ਨੇ ਜਿਨ੍ਹਾਂ ਨੂੰ ਜਿਵੇਂ ਆਪਾਂ ਮਾਈਨੋਰਿਟੀ ਸਕੋਲਰਸ਼ਿਪਸ ਪ੍ਰੋਗਰਾਮ ਉਹਨੂੰ ਕਹਿੰਦੇ ਹਾਂ ਮਨੋਰਟੀ ਸਕੋਲਰਸ਼ਿਪ ਪ੍ਰੋਗਰਾਮ 'ਚ ਵੀ ਹੁੰਦਾ ਕਿ ਜਿਹੜੇ ਮਾਈ ਮਤਲਬ ਮਾਈਨੋਰਿਟੀ ਦੇ ਵਿੱਚ ਰਹਿ ਰਹੇ ਨੇ ਇਕੋਨਮੀ ਦੇ ਵਿੱਚ ਬੰਦੇ ਉਹਨਾਂ ਨੂੰ ਜਿਹੜੇ ਨੇ ਉਹ ਪੈਸੇ ਵਗੈਰਾ ਜਿਹੜੇ ਉਹ ਪ੍ਰੋਵਾਈਡ ਕਰਦੇ ਨੇ ਜਿਹਦੀ ਉਹਨਾਂ ਨੇ ਫੀਸ ਭਰੀ ਹੁੰਦੀ ਉਹਦਾ ਕੁਝ ਪਰਸੈਂਟੇਜ ਜਿਹੜਾ ਉਹਨਾਂ ਨੂੰ ਮਿਲ ਜਾਂਦਾ ਵੈ ਈਵਨ ਬਹੁਤ ਸਾਰੇ ਕੈਂਪ ਵੀ ਲਗਾ ਰਹੀ ਹੈ ਸਰਕਾਰ ਇਨ੍ਹਾਂ ਛੋਟੇ ਛੋਟੇ ਜ਼ਿਲ੍ਹਿਆਂ ਵਿੱਚ ਜਾ ਕੇ ਕਿ ਬਈ ਲੋਕਾਂ ਵਿੱਚ ਪੜ੍ਹਨ ਦੀ ਜਿਹੜੀ ਹੈ ਉਹ ਇੱਛਾ ਜਾਗੇ ਅਤੇ ਲੋਕਾਂ ਨੂੰ ਹੋਵੇ ਕਿ ਵੀ ਹਾਂ ਅਸੀਂ ਪੜ੍ਹਨਾ ਅਸੀਂ ਹੋਰ ਅੱਗੇ ਵਧਣਾ ਅਤੇ ਪੜ੍ਹਾਈ ਦਾ ਰੁਝਾਨ ਜਿਹੜਾ ਉਹਨਾਂ ਦੇ ਵਿੱਚ ਵਧਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਜਾ ਰਹੀ ਹੈ